ਖੇਡਾਂ ਵਿੱਚ ਸਪੌਸਰਾਂ ਦੀ ਅਤੇ ਇਸ਼ਤਿਹਾਰ ਦੇਣ ਵਾਲਿਆਂ ਦੀ ਭੂਮਿਕਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਿਸ ਨਾਲ਼ ਕੀ ਹੈ ਕਿ ਖੇਡਾਂ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਿਆ ਜਾ ਸਕਦਾ ਏ ਜਿਵੇਂ ਕਿ ਬਾਹਰੋਂ ਵੱਡੇ ਵੱਡੇ ਜਿਹੜੇ ਪਲੇਅਰਸ ਹੁੰਦੇ ਨੇ ਖਿਡਾਰੀ ਹੁੰਦੇ ਹੈ ਉਹਨਾਂ ਉਹ ਖੇਡ ਨੂੰ ਸ਼ਤਾ ਉਹ ਉਤਸ਼ਾਹਿਤ ਕਰਦੇ ਹੈ ਇਸ ਲਈ ਉਹਨਾਂ ਨੂੰ ਸਪੌਂਸਰਸ਼ਿੱਪਾਂ ਦਿੱਤੀਆਂ ਜਾਂਦੀਆਂ ਨੇ